ਬੀਜ ਪੌਦੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਕਈ ਬੋ ਕਈ ਪੌਦੇ ਬੀਜਾਂ ਤੋਂ ਬਿੰਨ੍ਹਾਂ ਉੱਗਦੇ ਹਨ ਅਤੇ ਕਈ ਬੀਜਾਂ ਨਾਲ ਉੱਗਦੇ ਹਨ ਬੀਜ ਇੱਕ ਭੂਰਨ ਵਾਲਾ ਪੌਦਾ ਹੁੰਦਾ ਹੈ ਜੋ ਇੱਕ ਸੁਰੱਖਿਆ ਵਾਲੀ ਬਾਹਰ ਦੇ ਕਵਰ ਦੇ ਵਿੱਚ ਹੁੰਦਾ ਹੈ ਬੀਜ ਦੀ ਸਹਾਇਤਾ ਨਾਲ ਅਸਲ ਵਿਕਾਸ ਹੁੰਦਾ ਹੈ ਜਿਸ ਨਾਲ ਪੌਦਾ ਪੂਰਨ ਤੌਰ 'ਤੇ ਵੱਧਦਾ ਫੁੱਲਦਾ ਹੈ ਇਸ ਦਾ ਸਹੀ ਤਰ੍ਹਾਂ ਨਾਲ ਵਿਕਾਸ ਹੁੰਦਾ ਹੈ ਬੀਜ ਅ ਬੜੀ ਅਸਾਨੀ ਨਾਲ ਬੀਜਾਂ ਵਾਲੀ ਦੁਕਾਨ ਤੋਂ ਮਿਲ ਜਾਂਦਾ ਹੈ ਜੋ ਕਿ ਆਪਾਂ ਘਰ ਲਿਆ ਕੇ ਆਪਾਂ ਆਪਣੇ ਪੌਦੇ ਵਿੱਚ ਪਾ ਕੇ ਉਸਨੂੰ ਬੜੀ ਸੋ ਸਹੀ ਤਰ੍ਹਾਂ ਆਪਾਂ ਬੀਜ ਉਗਾ ਸਕਦੇ ਹਾਂ ਇਸ ਨਾਲ ਸਾਨੂੰ ਆਪਣੇ ਘਰ ਵਿੱਚ ਆਪਣੇ ਆਪਣੇ ਮਤਲਬ ਦੀਆਂ ਸਬਜ਼ੀਆਂ ਵਗੈਰਾ ਹਰ ਚੀਜਾਂ ਤਿਆਰ ਕਰ ਸਕਦੇ ਹਾਂ ਕਉਂਕਿ ਆਪਾਂ ਨੂੰ ਘਰ ਬੀਜੀਆਂ ਹੋਈਆਂ ਸਬਜ਼ੀਆਂ ਦਾ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਇਸ ਕਰਕੇ ਇਸਨੂੰ ਬਹੁਤ ਹੀ ਵਧੀਆ ਕਿਹਾ ਜਾਂਦਾ ਹੈ ਛੀ ਹਾਂਜੀ